ਮੈਨੇ ਇੱਕ ਵਾਰੀ ਮੈਰਾਥੋਨ ਵਿੱਚ ਪਾਰਟੀਸਪੇਟ ਕੀਤਾ ਸੀ ਜੋ ਕਿ ਪੰਜ ਸੌ ਮੀਟਰ ਦੀ ਸੀ ਇਸ ਦੀ ਤਿਆਰੀ ਮੈਨੇ ਦੋ ਹਫਤੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਮੈਂ ਰੋਜ਼ ਪੰਜ ਸੌ ਜਾਂ ਸਾਢੇ ਸੱਤ ਸੌ ਮੀਟਰ ਦੇ ਦਸ ਚੱਕਰ ਲਾਉਂਦਾ ਸੀ ਜਿਸ ਕਾਰਨ ਮੇਰਾ ਸਟੈਮਿਨਾ ਵੱਧ ਸਕੇ ਜੋ ਕਿ ਮੈਨੂੰ ਮੇਰੀ ਜਿੱਤ ਦੇ ਵਿੱਚ ਬਹੁਤ ਹੀ ਮਦਦਗਾਰ ਸੀ ਮੈਨੂੰ ਪੰਜ ਸੌ ਮੀਟਰ ਦੀ ਜਿੱਤ ਬਹੁਤ ਹੀ ਜ਼ਿਆਦਾ ਖੁਸ਼ੀਆਂ ਦਿੰਦੀ ਹੈ ਜੋ ਕਿ ਮੈਨੇ ਬਹੁਤ ਜ਼ਿਆਦਾ ਹੀ ਮਿਹਨਤ ਕੀਤੀ ਸੀ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ ਉਹ ਪੰਜ ਸੌ ਮੀਟਰ ਰੇਸ ਦਾ